ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਬਸ ਵਧੀਆ ਭੈਣ ਜੀ ਤੁਸੀਂ ਸੁਣਾਓ ਆਪਣਾ ਕੁਝ ਨਹੀਂ ਭੈਣ ਜੀ ਵਿਹਲੇ ਟੀਵੀ ਦੇਖ ਰਹੀ ਸੀ ਮੈਂ ਹਾਂਜੀ ਭੈਣ ਜੀ ਬਹੁਤ ਜ਼ਿਆਦਾ ਵੱਧ ਚੁੱਕੇ ਦਾ ਹੈਗਾ ਗਾ ਮੈਂ ਤਾਂ ਖੁਦ ਬਹੁਤ ਪਰੇਸ਼ਾਨ ਹੋ ਚੁੱਕੀ ਕੱਲ੍ਹ ਹੀ ਮੈਂ ਆਪਣੀ ਸਕੂਟੀ ਲੈ ਕੇ ਗਈ ਸੀ ਮੇਰਾ ਐਕਸੀਡੈਂਟ ਹੋਣ ਲੱਗਾ ਕਿਉਂਕਿ ਜਿਹੜਾ ਮਤਲਬ ਇੱਥੇ ਪਠਾਨਕੋਟ ਦਾ ਟ੍ਰੈਫਿਕ ਪੁਲਿਸ ਆ ਉਹ ਵੀ ਉਸਨੂੰ ਕੰਟਰੋਲ ਨਹੀਂ ਕਰ ਪਾ ਰਹੀ ਆ ਅਤੇ ਲੋਕਾਂ ਨੇ ਗੱਡੀਆਂ ਫੁਟਪਾਥ 'ਤੇ ਕੀਤੀਆਂ ਨੇ ਲੋਕ ਇੰਨੀ ਜ਼ਿਆਦਾ ਤੇਜ਼ ਗੱਡੀਆਂ ਚਲਾਉਂਦੇ ਹਾਂ ਉਹਨਾਂ ਦੀ ਰਫਤਾਰ ਕੱਲ੍ਹ ਮੇਰਾ ਐਕਸੀਡੈਂਟ ਹੁੰਦੇ ਹੁੰਦੇ ਬਚਿਆ ਤਾਂ ਮੈਂ ਸਮਾਂ ਬੱਚ ਪਾਈ ਆ ਹਾਂਜੀ ਭੈਣ ਜੀ ਉਹ ਤਾਂ ਹੱਥ 'ਤੇ ਹੱਥ ਧਰ ਕੇ ਰੱਖੀ ਵੀ ਹੈ ਬਜ਼ਾਰ 'ਚ ਨਿਕਲ ਕੇ ਦੇਖੋ ਤੁਸੀਂ ਨਿਕਲਣਾ ਮੁਸ਼ਕਿਲ ਹੋਏ ਦਾ ਸਾਡਾ ਤਾਂ ਬਹੁਤ ਜ਼ਿਆਦਾ ਹਾਂਜੀ ਹਾਂਜੀ ਮੈਂ ਤੁਹਾਡੇ ਸਾਥ ਨਾਲ ਹੈ ਜੀ ਅਸੀਂ ਵੀ ਪੁਲਿਸ ਦੇ ਨਾਲ ਪੂਰੀ ਆਪਣਾ ਸਹਿਯੋਗ ਦੇਵਾਂਗੇ ਜੀ ਇਸ ਕੰਮ ਦੇ ਵਿੱਚ ਤੁਹਾਡੇ ਓਕੇ ਜੀ ਮਿਹਰਬਾਨੀ ਭੈਣ